ਹਾਂਜੀ ਮੇਰਾ ਜ਼ਿੰਦਗੀ ਦਾ ਨਿੱਜੀ ਟੀਚਾ ਹੈ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨਾ ਅਤੇ ਉਹਨਾਂ ਨੂੰ ਨਸ਼ੇ ਤੋਂ ਮੁਕਤ ਕਰਵਾਉਣਾ ਅੱਜ ਕੱਲ੍ਹ ਪੰਜਾਬ ਦੇ ਵਿੱਚ ਬੜੇ ਜਿਹੜੇ ਹੈਗੇ ਨਸ਼ੇ ਚੱਲ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਮੈਂ ਇਹੀ ਕਹਿੰਦਾ ਹਾਂ ਕਿ ਤੁਸੀਂ ਇਹ ਨਸ਼ੇ ਤੋਂ ਮੁਕਤ ਹੋਵੋ ਨਸ਼ਾ ਜਿਹੜਾ ਹੈਗਾ ਤੁਹਾਨੂੰ ਤੁਹਾਡੀ ਜ਼ਿੰਦਗੀ ਬਰਬਾਦ ਕਰੇਗਾ ਏ ਕਰੇਗਾ ਤੁਹਾਡੇ ਘਰ ਦੀ ਬਰਬਾਦੀ ਵੀ ਕਰੇਗਾ ਧੰਨਵਾਦ